ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਅਸੀਂ ਤੁਹਾਡੇ ਰੈਸਟੋਰੈਂਟ ਦੇ ਬਾਹਰੋਂ ਗੁਜ਼ਰ ਰਹੇ ਸੀ ਅਤੇ ਸਾਨੂੰ ਬਾਹਰੋਂ ਦੇਖ ਕੇ ਥੋੜਾ ਰੈਸਟੋਰੈਂਟ ਬਹੁਤ ਵਧੀਆ ਲੱਗਾ ਹੁਣ ਅੰਦਰ ਆਏ ਆ ਅਸੀਂ ਸਾਨੂੰ ਦੁਪਹਿਰ ਦਾ ਸਮਾਂ ਵੈਸੇ ਵੀ 'ਤੇ ਅਸੀਂ ਚਾਹੁੰਦੇ ਸੀ ਕੀ ਅਸੀਂ ਭੋਜਨ ਕੀਤਾ ਜਾਵੇ ਮੈਂ ਆਪਣੇ ਪਰਿਵਾਰ ਨਾਲ਼ ਆਇਆ ਜੋ ਕੀ ਤੁਸੀਂ ਦੇਖ ਸਕਦੇ ਓ ਪਰਿਵਾਰ ਨੂੰ ਵੀ ਤੁਹਾਡਾ ਰੈਸਟੋਰੈਂਟ ਬਹੁਤ ਵਧੀਆ ਲੱਗਿਆ ਅਤੇ ਮੈਂ ਤੁਹਾਨੂੰ ਆਪਣਾ ਔਡਰ ਲਿਖਾਉਣਾ ਚਾਹੁੰਦਾ ਤੁਸੀਂ ਮੇਰਾ ਕਿਰਪਾ ਕਰਕੇ ਔਡਰ ਲਿਖ ਲੋ ਪਹਿਲਾਂ ਦਾਲ ਮੱਖਣੀ ਦਸ ਤੰਦੂਰੀ ਰੋਟੀਆਂ ਅਤੇ ਇੱਕ ਸ਼ਾਹੀ ਪਨੀਰ ਅਤੇ ਇੱਕ ਰਾਇਤਾ ਤੁਸੀਂ ਉਸ ਤੋਂ ਪਹਿਲਾਂ ਮੈਨੂੰ ਡਿਸਪੋਸਲ ਪਲੇਟਾਂ ਕਾਂਟਾ ਚਮਚਾ ਵਗੈਰਾ ਦੇ ਦੋ ਤਾਂ ਕੀ ਜਦੋਂ ਤੁਸੀਂ ਭੋਜਨ ਲੈ ਕੇ ਆਓ ਅਤੇ ਅਸੀਂ ਉਸ ਵਿੱਚ ਭੋਜਨ ਦਾ ਆਨੰਦ ਲੈ ਸਕੀਏ